ਜਿਹੜੇ ਮਤਲਬ ਇੰਜੋਏਮੈਂਟ ਲਈ ਜਿਹੜੇ ਮਨੋਰੰਜਕ ਗਤੀਵਿਧੀਆਂ ਲਈ ਜੋ ਆਪਾਂ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਕਾਫੀ ਸਾਰੇ ਜਿਹੜੇ ਹੈਗੇ ਨੇ ਉਹ ਬਣੇ ਹੋਏ ਨੇ ਫਨ ਵਰਲਡ ਵਗੈਰਾ ਜਿਵੇਂ ਢਿੱਲੋ ਫਨ ਵਰਲਡ ਹੋ ਗਿਆ ਸਾਡੇ ਪਟਿਆਲੇ 'ਚ ਹੈਗਾ ਉੱਥੇ ਜਿੱਦਾਂ ਵੋਟਰ ਪਾਰਕ ਹੈ ਨਾ ਅਤੇ ਇਹਦੇ ਨਾਲ ਆਪਾਂ ਨੂੰ ਇੰਜੋਏਮੈਂਟ ਬਹੁਤ ਹੁੰਦੀ ਹੈ ਵੀ ਇੰਜੋਏਮੈਂਟ ਹੁੰਦੀ ਹੈ ਜਦੋਂ ਫਿਰ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਨਾਲ ਵਧੀਆ ਟਾਈਮ ਸਪੈਂਡ ਹੋ ਜਾਂਦਾ ਸਨ ਸਿਟੀ ਹੋ ਗਈ ਅੰਮ੍ਰਿਤਸਰ ਦੇ ਵਿੱਚ ਅਤੇ ਫਨ ਵਰਲਡ ਇੱਕ ਉਹਦੇ ਵਿੱਚ ਵੀ ਹੈਗਾ ਰਾਜਪੁਰੇ ਵਿੱਚ ਵੀ ਹੈ ਥੰਡਰ ਜੋਨ ਹੈਗਾ ਇੱਕ ਇਹ ਸਾਰੀਆਂ ਜਿਹੜੀਆਂ ਜਗ੍ਹਾਵਾਂ ਨੇ ਇਹ ਮਨੋਰੰਜਨ ਦਾ ਸਾਧਨ ਨੇ ਕੋਈ ਵੀ ਪੰਜਾਬ ਆਉਂਦਾ ਹੈ ਠੰਡਰ ਜੋਨ ਉੱਥੇ ਜਾ ਸਕਦਾ ਫਨ ਸਿਟੀ ਅਤੇ ਲੁਧਿਆਣੇ ਵਿੱਚ ਹੈ ਸ਼ਾਇਦ ਅਤੇ ਐਮਯੂਜ਼ਮੈਂਟ ਪਾਰਕਸ ਦੇ ਵਿੱਚ ਤੁਸੀਂ ਜਾ ਸਕਦੇ ਹੋ ਜਿਹੜਾ ਵੀ ਪੰਜਾਬ ਆਏ ਪਟਿਆਲੇ ਆਏ

ਰਿਸ਼ੀਕੇਸ਼ ਦੇ ਵਿੱਚ ਜਿਵੇਂ ਰੀਵਰ ਆ ਰਾਫਟਿੰਗ ਹੈਗੀ ਪੰਜਾਬ ਦੇ ਵਿੱਚ ਸ਼ਾਇਦ ਇਹ ਅਤੇ ਕਾਫੀ ਜ਼ਿਆਦਾ ਮਨੋਰੰਜਨ ਦੇ ਸਾਧਨ ਨੇ ਉੱਥੇ ਵੀ ਜਾ ਸਕਦੇ ਅਸੀਂ ਅਤੇ ਰੇਨਬੋ ਵਾਟਰ ਪਾਰਕ ਵੀ ਹੈਗਾ ਅੰਮ੍ਰਿਤਸਰ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਘੁੰਮਣ ਨੂੰ ਦੇਖਣ ਨੂੰ ਮਿਲ ਜਾਂਦੀਆਂ ਜੀ ਧੰਨਵਾਦ